ਵੈਸੇ ਤਾਂ ਮੈਨੂੰ ਚਿੱਤਰਕਾਰੀ ਅਤੇ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਅਤੇ ਮੈਨੂੰ ਜਦ ਵੀ ਖਾਲੀ ਸਮਾਂ ਮਿਲਦਾ ਹੈ ਮੈਂ ਜ਼ਰੂਰ ਪੇਂਟਿੰਗ ਕਰਨਾ ਪਸੰਦ ਕਰਦੀ ਹਾਂ ਵੈਸੇ ਮੈਂ ਸਕੂਲ ਵਿੱਚ ਵੀ ਇੱਕ ਸ ਵਿਸ਼ਾ ਲਿਤਾ ਸੀ ਜੋ ਕਿ ਡਰਾਇੰਗ ਨਾਮ ਦਾ ਵਿਸ਼ਾ ਸੀ ਔਰ ਮੈਨੂੰ ਉਹ ਕਲਾਸ ਲਗਾਉਣੀ ਵੀ ਬਹੁਤ ਪਸੰਦ ਆਉਂਦੀ ਸੀ ਜਦ ਵੀ ਮੇਰੀ ਮੈਮ ਕਲਾਸ ਵਿੱਚ ਆਉਂਦੇ ਸੀ ਨਾ ਉਹ ਅਲੱਗ ਅਲੱਗ ਸਾਨੂੰ ਪੇਂਟਿੰਗ ਕਰਨ ਨੂੰ ਦੇ ਦਿੰਦੇ ਸਨ ਅਤੇ ਉਸ ਵਿੱਚ ਮੈਂ ਬਹੁਤ ਅਲੱਗ ਅਲੱਗ ਤਰੀਕੇ ਦੇ ਕਲਰ ਇਸਤੇਮਾਲ ਕਰਕੇ ਉਹ ਪੇਂਟਿੰਗ ਨੂੰ ਬਹੁਤ ਖੂਬਸੂਰਤ ਬਣਾਉਣ ਦੀ ਹਮੇਸ਼ਾਂ ਕੋਸ਼ਿਸ਼ ਕਰਦੀ ਸੀ ਅਤੇ ਇਸ ਲਈ ਮੈਨੂੰ ਮੇਰੇ ਅਧਿਪ ਅਧਿਆਪਕਾਂ ਤੋਂ ਸਰਾਹਨਾ ਵੀ ਮਿਲਦੀ ਸੀ ਇੱਕ ਵਾਰੀ ਕੰਪੀਟੀਸ਼ਨ ਵਿੱਚ ਵੀ ਮੈਂ ਭਾਗ ਲਿਆ ਸੀ ਜਿਸ ਵਿੱਚ ਅ ਇੱਕ ਮੁਕਾਬਲਾ ਕਰਵਾਇਆ ਗਿਆ ਸੀਗਾ ਇੱਕ ਕੁਦਰਤ ਨੂੰ ਬਣਾਉਣਾ ਸੀਗਾ ਅਤੇ ਉਸ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੰਗ ਇਸਤੇਮਾਲ ਕਰਨੇ ਸੀ ਪਰ ਉਸ ਵਕਤ ਮੈਨੂੰ ਕੋਈ ਵੀ ਆਈਡੀਆ ਨਹੀਂ ਸੀ ਫਿਰ ਵੀ ਮੈਂ ਆਪਣੇ ਤਰੀਕੇ ਨਾਲ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੈਂ ਉਸ ਚੀਜ਼ ਨੂੰ ਬਹੁਤ ਅੱਛਾ ਬਣਾਵਾਂ ਹਾਂ ਔਰ ਇਹ ਅੰਤ ਵਿੱਚ ਬਣ ਗਿਆ ਸੀਗਾ ਪਰ ਮੈਨੂੰ ਪਤਾ ਨਹੀਂ ਸੀ ਕਿ ਦੂਸਰਿਆਂ ਨੂੰ ਪਸੰਦ ਆਏਗਾ ਕਿ ਨਹੀਂ ਲੇਕਿਨ ਮੈਂ ਉਸ ਵਿੱਚ ਵੀ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਆਪਣੀ ਇਸ ਕਲਾ ਨੂੰ ਅ ਵਧਾਉਣ ਦੀ ਤਾਂ ਮੈਂ ਹਮੇਸ਼ਾਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਆਪਣੀ ਇਸ ਕਲਾ ਨੂੰ ਬਹੁਤ ਹੱਦ ਤੱਕ ਹੋਰ ਅੱਗੇ ਵਧਾਵਾਂ ਹੋਰ ਵਧੀਆ ਕਰਾਂ ਜਿਸ ਲਈ ਮੈਂ ਕਈ ਵਾਰੀ ਯੂਟਿਊਬ ਚੈਨਲਾਂ ਦੀ ਮਦਦ ਵੀ ਲੈ ਲੈਂਦੀ ਹਾਂ ਤਾਂ ਕਿ ਮੈਂ ਆਪਣੇ ਅ ਕਲਾ ਨੂੰ ਵਿੱਚ ਹੋਰ ਕੁਛ ਵੀ ਸਾ ਸ਼ਾਮਿਲ ਕਰ ਸਕਾਂ ਅਤੇ ਇਸ ਨੂੰ ਵਧੀਆ ਤਰੀਕੇ ਨਾਲ ਉਜਾਗਰ ਕਰ ਸਕਾਂ